ਪੇਂਡੂ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਵਿੱਚ ਮੁਸ਼ਕਿਲਾਂ ਤਾਂ ਆਉਂਦੀਆਂ ਹਨ ਕਿਉਂਕਿ ਪਿੰਡਾਂ ਦੇ ਲੋਕ ਥੋੜ੍ਹਾ ਸ਼ਹਿਰਾਂ ਦੇ ਲੋਕਾਂ ਨਾਲੋਂ ਘੱਟ ਪੜ੍ਹੇ ਲਿਖੇ ਹੁੰਦੇ ਹਨ ਅਤੇ ਉਸ ਪਿੰਡਾਂ ਦੇ ਲੋਕ ਜ਼ਿਆਦਾਤਰ ਆਪਣੇ ਮਾਮਲੇ ਸ਼ ਜਾਂ ਸ਼ ਪਿੰਡ ਤੱਕ ਹੀ ਰੱਖਦੇ ਹਨ ਅਤੇ ਵਕੀਲ ਪੁਲਿਸ ਸਟੇਸ਼ਨ ਅਦਾਲਤਾਂ ਤੱਕ ਘੱਟ ਹੀ ਜਾਂਦੇ ਹਨ ਪਰ ਜੇ ਕਿਤੇ ਉਹਨਾਂ ਨੂੰ ਜਾਣਾ ਪਵੇ ਤਾਂ ਉਹਨਾਂ ਨੂੰ ਮੁਸ਼ਕਿਲ ਆਉਂਦੀ ਹੈ ਅਤੇ ਉਹ ਕਿਸੇ ਪੜ੍ਹੇ ਲਿਖੇ ਆਪਣੇ ਸਪੁੱਤਰ ਜਾਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਕਿਸੇ ਆਪਣੇ ਮਿੱਤਰ ਨੂੰ ਨੂੰ ਲੈ ਕੇ ਜਾ ਸਕਦੇ ਹਨ ਕਿਉਂਕਿ ਅੱਜ ਕੱਲ੍ਹ ਬਹੁਤ ਲੋਕ ਪੜ੍ਹ ਲਿਖ ਗਏ ਹਨ ਪਿੰਡਾਂ ਦੇ ਲੋਕਾਂ ਨੂੰ ਥੋੜ੍ਹੀ ਜਿਹੀ ਦਿੱਕਤ ਆਉਂਦੀ ਹੈ ਪਰ ਹੁਣ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਹੈ ਪਿੰਡਾਂ ਦੇ ਲੋਕ ਵੀ ਹੁਣ ਬਹੁਤ ਸਿਆਣੇ ਹੋ ਗਏ ਹਨ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਇਹ ਕਰਨਾ ਪੈਂਦਾ ਹੈ ਕਿ ਉਹਨਾਂ ਨੂੰ ਵਕੀਲਾਂ ਦੀ ਲੈਂਗੁਏਜ ਵਕੀਲਾਂ ਦੀ ਭਾਸ਼ਾ ਸਮਝਣੀ ਥੋੜ੍ਹੀ ਜਿਹੀ ਔਖੀ ਲੱਗਦੀ ਹੈ ਪੁਲਿਸ ਸਟੇਸ਼ਨਾਂ ਦੀ ਵੀ ਉਹਨਾਂ ਦੇ ਕਾਨੂੰਨ ਉਹਨਾਂ ਨੂੰ ਉਹਨਾਂ ਨੂੰ ਸਮਝਣੇ ਔਖੇ ਲੱਗਦੇ ਹਨ ਤਾਂ ਉਹ ਕੈਦ ਆਪਣੇ ਪੰਚਾਇਤ ਤੱਕ ਹੀ ਮਾਮਲੇ ਨੂੰ ਨਿਪਟਾ ਲੈਣਾ ਚਾਹੁੰਦੇ ਹਨ ਅਤੇ ਇਸ ਲਈ ਉਹਨਾਂ ਨੂੰ ਮੁਸ਼ਕਿਲਾਂ ਦਾ ਥੋੜ੍ਹਾ ਸਾਹਮਣਾ ਕਰਨਾ ਪੈਂਦਾ ਹੈ